ਨਵੇਂ ਪਕਵਾਨਾਂ ਬਾਰੇ ਸਿੱਖਣ ਲਈ ਮੈਂ ਬਹੁਤ ਸਾਰੀਆਂ ਵਿਧੀਆਂ ਦੀ ਪਾਲਣਾ ਕਰਦੀ ਹਾਂ ਕਿਉਂਕਿ ਅੱਜ ਕੱਲ੍ਹ ਬਹੁਤ ਨਵੇਂ ਨਵੇਂ ਪਕਵਾਨ ਆ ਰਹੇ ਹਨ ਜਿਵੇਂ ਕਿ ਚਾਈਨੀਸ ਜਿਨ੍ਹਾਂ ਬਾਰੇ ਪੰਜਾਬ ਦੇ ਲੋਕਾਂ ਨੂੰ ਬਹੁਤ ਘੱਟ ਜਾਣਕਾਰੀ ਹੈ ਅਤੇ ਇਸ ਦੇ ਮਸਾਲੇ ਵੀ ਸਾਡੇ ਪੰਜਾਬ ਨਾਲੋਂ ਅਲੱਗ ਹਨ ਅਤੇ ਮੈਂ ਇਨ੍ਹਾਂ ਡਿਸ਼ਿਸ ਨੂੰ ਬਣਾਉਣ ਲਈ ਟੀ ਵੀ ਸ਼ੋਅ ਯੂਟਿਊਬ ਵੀਡੀਓ ਅਤੇ ਇੰਸਟਾਗ੍ਰਾਮ ਦੀ ਵਰਤੋਂ ਕਰਦੀ ਹਾਂ ਅਤੇ ਮੈਂ ਟੀ ਵੀ ਸ਼ੋਅ ਉੱਤੇ ਬਹੁਤ ਸਾਰੇ ਸ਼ੋਅ ਦੇਖੇ ਹਨ ਜੋ ਕਿ ਇਨ੍ਹਾਂ ਪਕਵਾਨਾਂ ਨੂੰ ਬਣਾਉਣ ਲਈ ਮੁਕਾਬਲੇ ਕਰਾਉਂਦੇ ਹਨ ਅਤੇ ਜਿੱਥੇ ਕਿ ਬਹੁਤ ਬਹੁਤ ਮਸ਼ਹੂਰ ਸ਼ੈੱਫ ਆਏ ਹੁੰਦੇ ਹਨ ਅਤੇ ਉਹ ਇਨ੍ਹਾਂ ਨੂੰ ਲੰਬੇ ਸਮੇਂ ਤੱਕ ਰੱਖਣ ਲਈ ਜਾਂ ਬਹੁਤ ਘੱਟ ਸਮੇਂ ਵਿੱਚ ਬਣਾਉਣ ਲਈ ਨਵੀਆਂ ਨਵੀਆਂ ਨਵੇਂ ਨਵੇਂ ਤਰੀਕੇ ਦੱਸਦੇ ਹਨ ਜਿਨ੍ਹਾਂ ਦੀ ਮਦਦ ਨਾਲ ਮੈਂ ਇੱਕ ਬਹੁਤ ਚੰਗੀ ਕੁੱਕ ਬਣ ਸਕਦੀ ਹਾਂ